ਅਮਿਤਾਬ ਬੱਚਨ ਸੋਨਮ ਬਾਜਵਾ ਦਲਜੀਤ ਦੋਸਾਂਝ ਚਮਕੀਲਾ ਸ਼ੁਭਮਨ ਗਿੱਲ ਨਿਰਮਲ ਰਿਸ਼ੀ ਬੱਬੂ ਮਾਨ ਸਿੱਧੂ ਮੂਸੇਵਾਲਾ ਸਚਿਨ ਤੇਂਦੂਲਕਰ ਕਪਿਲ ਦੇਵ ਹਾਰਦਿਕ ਪਾਂਡੇ ਵਿਰਾਟ ਕੋਹਲੀ